ਹਾਂਜੀ ਪਰਿਵਾਰ ਅਤੇ ਗਲੀ ਮੁਹੱਲਿਆਂ ਦੇ ਵਿੱਚ ਝਗੜੇ ਆਮ ਤੌਰ ਜਿਹੀ ਗੱਲ ਹੈ ਹੋ ਜਾਂਦੀ ਹੈ ਸਾਡੇ ਹੀ ਪਿੰਡ ਦੀ ਇੱਕ ਕਹਾਣੀ ਹੈ ਸਾਡੇ ਹੀ ਪਿੰਡ ਇੱਕ ਛੋਟੇ ਜਿਹੇ ਪਰਿਵਾਰ 'ਚ ਇੱਕ ਆਪਸੀ ਤਨਾਵ ਹੋਣ ਕਰਕੇ ਇੱਕ ਝਗੜਾ ਪੈਦਾ ਹੋਇਆ ਉਹਦੇ ਵਿੱਚ ਇੱਕ ਝਗੜੇ ਦੇ ਵਿੱਚ ਸਿਰਫ ਥੋੜ੍ਹੀ ਜਿਹੀ ਬਹਿਸਬਾਜ਼ੀ ਹੋਈ ਜੋ ਕਿ ਅਸੀਂ ਹੱਲ ਕੀਤਾ ਗਿਆ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਸਮਝਾਇਆ ਐਂਡ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਅਸੀਂ ਸਰਪੰਚ ਕੋਲ ਗਏ ਤਾਂ ਕਿ ਸਾਡੇ ਸਰਪੰਚ ਹੈ ਜੋ ਪਿੰਡ ਦਾ ਬਹੁਤ ਹੀ ਵਧੀਆ ਅਤੇ ਹੋਣਹਾਰ ਇਨਸਾਨ ਹੈ ਉਸ ਤੋਂ ਬਾਅਦ ਉਹਨਾਂ ਨੇ ਬਿਠਾਇਆ ਦੋਨੋਂ ਪਰਿਵਾਰਾਂ ਨੂੰ ਉਸ ਤੋਂ ਬਾਅਦ ਉਸ ਝਗੜੇ ਦਾ ਨਿਪਟਾਰਾ ਕੀਤਾ ਗਿਆ ਅਤੇ ਦੋਨੋਂ ਹੀ ਪਰਿਵਾਰਾਂ ਨੂੰ ਸਮਝਾ ਕੇ ਔਰ ਸਹਿਮਤੀ ਨਾਲ ਫੈਸਲਾ ਸੁਣਾਇਆ ਗਿਆ ਸਰਪੰਚ ਵੱਲੋਂ